ਸਭ ਤੋਂ ਵਧੀਆ ਯਾਤਰਾ ਮੇਰੀ ਮੇਰੇ ਦੋਸਤਾਂ ਨਾਲ ਹੋਈ ਹੈ ਜੋ ਕਿ ਸੀ ਸਾਡੀ ਕੋਲਜ ਟਰਿੱਪ ਜਿੱਥੇ ਕਿ ਅਸੀਂ ਸਾਰਿਆਂ ਦੋਸਤਾਂ ਨੇ ਮਿਲ ਕੇ ਸੋਚਿਆ ਕਿ ਅਸੀਂ ਇਸ ਟਰਿੱਪ 'ਤੇ ਜਾਵਾਂਗੇ ਅਤੇ ਅਸੀਂ ਗਏ ਸੀ ਸ਼ਿਮਲਾ ਮਨਾਲੀ ਉਹ ਵੀ ਪੰਜ ਦਿਨ ਲਈ ਅਤੇ ਅਸੀਂ ਬਹੁਤ ਖੁਸ਼ ਸੀਗੇ ਜਿੱਥੇ ਕਿ ਸਾਨੂੰ ਸਾਰੇ ਦੋਸਤਾਂ ਨੂੰ ਆਪਣੇ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਿਆ ਸੀ ਜੋ ਕਿ ਅਸੀਂ ਕਾਫ਼ੀ ਟਾਈਮ ਤੋਂ ਨਹੀਂ ਦੇ ਪਾ ਰਹੇ ਸਨ ਕੋਈ ਕਿੱਥੇ ਵਿਅਸਤ ਸੀ ਕੋਈ ਕਿੱਥੇ ਵਿਅਸਤ ਸੀ ਬਟ ਇਹ ਮੌਕਾ ਸਾਡੇ ਲਈ ਬਹੁਤ ਜ਼ਰੂਰੀ ਸੀਗਾ ਕਿ ਸਾਰੇ ਸਾਰਿਆਂ ਨੂੰ ਇੱਕ ਨਾਲ ਇੱਕ ਸਾਥ ਘੁੰਮਣ ਦਾ ਮੌਕਾ ਮਿਲਿਆ ਅਤੇ ਅਸੀਂ ਬਹੁਤ ਖੁਸ਼ ਹੋਏ ਸਨ ਅਤੇ ਸਾਰੇ ਸਾਰੇ ਦੋਸਤ ਵੀ ਖੁਸ਼ ਸਨ ਅਤੇ ਉੱਥੇ ਜਾ ਕੇ ਅਸੀਂ ਸਾਨੂੰ ਸਾਰੇ ਟੀਚਰਾਂ ਅਤੇ ਸਾਰੇ ਦੋਸਤਾਂ ਨੇ ਟੀਚਰਾਂ ਨੇ ਦੱਸਿਆ ਕਿ ਸਾਨੂੰ ਇੱਥੇ ਇੱਥੇ ਜਾਣਾ ਹੈ ਅਤੇ ਬਾਏ ਬੱਸ ਅਸੀਂ ਗਏ ਸਨ ਅਸੀਂ ਘੁੰਮਿਆ ਫਿਰਿਆ ਉੱਥੇ ਖਾਇਆ ਪੀਆ ਅਸੀਂ ਉੱਥੇ ਰਾਈਡਸ ਇੰਜੋਏ ਕੀਤੀਆਂ ਅਤੇ ਅਸੀਂ ਪਾਰਟੀਆਂ ਕੀਤੀਆਂ ਅਸੀਂ ਰਾਤ ਨੂੰ ਵੀ ਇੰਜੋਏ ਕੀਤਾ ਉੱਥੇ ਮਤਲਬ ਅਸੀਂ ਰਾਤ ਨੂੰ ਵੀ ਕਮਰੇ 'ਚ ਬਹੁਤ ਇੰਜੋਏ ਕੀਤਾ ਜਿਵੇਂ ਕਿ ਅਸੀਂ ਡਾਂਸ ਕੀਤਾ ਅਸੀਂ ਸਿੰਗਿੰਗ ਕੀਤੀ ਅਸੀਂ ਫਨ ਕੀਤਾ ਅਸੀਂ ਮਸਤੀ ਕੀਤੀ ਉਹ ਮੂਮੈਂਟ ਸਾਡੇ ਸਾਰਿਆਂ ਲਈ ਬਹੁਤ ਵਧੀਆ ਸੀ ਅਤੇ ਅਸੀਂ ਉਸ ਮੂਮੈਂਟ ਨੂੰ ਕਦੇ ਨਹੀਂ ਭੁੱਲ ਸਕਦੇ ਇਹ ਖ਼ਾਸ ਇਸ ਲਈ ਸੀ ਕਿਉਂਕਿ ਇਹ ਮੇਰੇ ਦੋਸਤਾਂ ਨਾਲ ਸੀ ਜੋ ਕਿ ਅਸੀਂ ਕਦੇ ਵੀ ਇੱਕ ਦੂਸਰੇ ਨੂੰ ਪ੍ਰੋਪਰਲੀ ਟਾਈਮ ਨਹੀਂ ਦੇ ਪਾ ਰਹੇ ਸਨ ਅਤੇ ਇਹ ਸਾਰੇ ਇੱਕ ਨਾਲ ਇਕੱਠੇ ਹੋਏ ਸਨ ਜਿਵੇਂ ਕਿ ਸਾਰੇ ਸਾਰਿਆਂ ਨੂੰ ਇੱਕ ਨਾਲ ਰਹਿਣ ਦਾ ਮੌਕਾ ਮਿਲਿਆ ਸੀ ਅਤੇ ਅਸੀਂ ਬਹੁਤ ਖੁਸ਼ ਸਨ